ਮੇਰਾ ਨਾਮ ਰਵਿੰਦਰ ਸਿੰਘ ਹੈ ਮੇਰਾ ਪਿੰਡ ਹੰਡਿਆਇਆ ਤੇ ਜਿਲਾ ਬਰਨਾਲਾ ਹੈ ਅਸੀਂ ਦੋ ਹਜਾਰ ਬਾਈ ਦੇ ਵਿੱਚ ਹਿਮਾਚਲ ਪ੍ਰਦੇਸ਼ ਮਹਾਲੀ ਤੱਕ ਮਨਾਲੀ ਤੱਕ ਘੁੰਮਣਗੇ ਉੱਥੇ ਅਸੀਂ ਕੁੱਲੂ ਮਨਾਲੀ ਕੁੱਲੂ ਤੋਂ ਕੁਛ ਕ ਕਿਲੋਮੀਟਰ ਦੂਰ ਬਿਜਲੀ ਮਹਾਦੇਵ ਗਏ ਬਿਜਲੀ ਮਹਾਦੇਵ ਦੀ ਚੜਾਈ ਬਿਜਲੀ ਮਹਾਦੇਵ ਦੀ ਚੜਾਈ ਪੰਦਰਾ ਕਿਲੋਮੀਟਰ ਤੋਂ ਵੱਧ ਸੀ ਅਸੀਂ ਉੱਥੇ ਚੜਦੇ ਚੜਦੇ ਦੋ ਢਾਈ ਘੰਟਿਆਂ ਦੇ ਵਿੱਚ ਸਫਰ ਕੀਤਾ ਇਹ ਸਫਰ ਮੰਡੀ ਤੋਂ ਕਈ ਕਿਲੋਮੀਟਰ ਦੂਰ ਕੂਲੂ ਕੁੱਲੂ ਕੂਲੂ ਤੋਂ ਇੱਕ ਸਾਈਡ ਤੇ ਰਹਿ ਜਾਂਦਾ ਹੈ ਬਿਜਲੀ ਮਹਾਦੇਵ ਉਸਦੀ ਚੜਾਈ ਬਹੁਤ ਜਿਆਦਾ ਹੈ ਤੇ ਅਸੀਂ ਹੌਲੀ ਹੌਲੀ ਦੋ ਤਿੰਨ ਘੰਟੇ ਦੇ ਵਿੱਚ ਚੜ੍ਹਾਈ ਪੂਰੀ ਕਰਦੇ ਸਮੇਂ ਅਸੀਂ ਹੌਲੀ ਹੌਲੀ ਪਹੁੰਚੇ ਉੱਥੇ ਬਿਜਲੀ ਮਹਾਦੇਵ ਪਹੁੰਚ ਗਏ ਬਿਜਲੀ ਮਹਾਦੇਵ ਅਸੀਂ ਦੇਖਿਆ ਉੱਥੇ ਜਮਾ ਲਾਸਟ ਦੀ ਉਤੇ ਕੋਈ ਪਹਾੜ ਨਹੀ ਸੀ ਜਦੋਂ ਲਾਸਟ ਤੇ ਪਹਾੜ ਸੀ ਅਸੀਂ ਉਥੇ ਦੇਖਿਆ ਇਨਾ ਰੋਮਨੀਕ ਸੁੰਦਰ ਮਾਹੌਲ ਆਸੇ ਪਾਸੇ ਸਾਰਾ ਹਰਾ ਹਰਾ ਘਾ ਉਹਦੇ ਆਸੇ ਪਾਸੇ ਪਹਾੜ ਦੀ ਆਸੇ ਪਾਸੇ ਬੱਦਲ ਤੇ ਉੱਤੇ ਨੀਲਾ ਅੰਬਰ ਦਿਖਾਈ ਦਿੰਦਾ ਸੀ ਉੱਥੇ ਇਨਾ ਹੀ ਮਨ ਕਰੇ ਕਿ ਸਾਰੀ ਜਿੰਦਗੀ ਉਥੇ ਹੀ ਬਤੀਤ ਕੀਤੀ ਜਾਵੇ ਉਥੇ ਛੋਟੇ ਛੋਟੇ ਟੈਂਟ ਲੱਗੇ ਹੋਏ ਤੇ ਛੋਟੀਆਂ ਛੋਟੀਆਂ ਸੁੰਦਰ ਸੁੰਦਰ ਦੁਕਾਨਾ ਤੇ ਮਿਠਿਆਈਆਂ ਤੇ ਹੋਰ ਹੀ ਐਟਮਾਂ ਬਣੀਆਂ ਹੋਈਆਂ ਸਨ ਤੇ ਬਿਜਲੀ ਮਹਾਦੇਵ ਦੀ ਮਹੱਤਤਾ ਹੈ ਕਿ ਉੱਥੇ ਬਿਜਲੀ ਗਿਰਦੀ ਹੈ ਤੇ ਸ਼ਿਵਜੀ ਮਹਾਰਾਜ ਦਾ ਲਿੰਗ ਬਿਖਰ ਜਾਂਦਾ ਹੈ ਤੇ ਬਿਖਰ ਕੇ ਆਪਣੇ ਆਪ ਹੀ ਤਿਆਰ ਹੋ ਜਾਂਦਾ ਹੈ